ਮੈਂ ਆਪਣੇ ਬੱਚਿਆਂ ਦੀ ਫ਼ੀਸ ਜਿਹੜੀ ਹੈਗੀ ਹੈ ਔਨਲਾਈਨ ਰਾਹੀਂ ਵੀ ਭੇ ਭਰ ਦਿੰਦੀ ਹਾਂ ਅਤੇ ਕਈ ਵਾਰੀ ਸਕੂਲ ਜਾ ਕੇ ਵੀ ਭਰ ਦਿੰਦੀ ਹਾਂ ਜਿਹਦੇ ਨਾਲ਼ ਮੈਨੂੰ ਅਸਾਨੀ ਵੀ ਹੁੰਦੀ ਹੈ ਅਤੇ ਹੁਣ ਜਿਸ ਤਰ੍ਹਾਂ ਮੇਰੇ ਬੱਚੇ ਅਬਰੌਡ ਜਿਹੜੀ ਸਟੱਡੀ ਕਰ ਰਹੇ ਹੈ ਔਨਲਾਈਨ ਰਾਹੀਂ ਉਹਨਾਂ ਦੀ ਪੇਮੈਂਟ ਕਰ ਦਿੰਦੀ ਹਾਂ ਜਿੱਦਾਂ ਸਮੇਂ ਦੀ ਵੀ ਬੱਚਤ ਹੁੰਦੀ ਹੈ ਅਤੇ ਟਾਈਮ ਟੂ ਟਾਈਮ ਜਿਹੜਾ ਹੈਗਾ ਸਮੇਂ ਤੋਂ ਸਮੇਂ ਉਹਨਾਂ ਨੂੰ ਜਿਹੜੇ ਹੈਗੇ ਪੇਮੈਂਟ ਜਲਦੀ ਤੋਂ ਜਲਦੀ ਪੌ ਪਹੁੰਚ ਜਾਂਦੀ ਹੈ